ਮੈਂ ਐਮਾ ਮੈਂ ਐਮਾਜੋਨ ਐਪ ਤੋਂ ਇੱਕ ਪੇਚਕਸ ਦੀ ਕਿੱਟ ਅੋਰਡਰ ਕੀਤੀ ਸੀ ਉਹ ਕਿੱਟ ਪਹਿਲਾਂ ਤਾਂ ਪੇਮੈਂਟ ਉਹਦੀ ਅਡਵਾਂਸ ਕੀਤੀ ਮੈਂ ਉਹ ਅਡਵਾਂਸ ਪੇਮੈਂਟ ਕੀਤੀ ਅਤੇ ਉਹ ਵਿਦਇਨ ਤਿੰਨ ਦਿਨਾਂ ਦੇ ਵਿੱਚ ਮੇਰੇ ਕੋਲ ਪਹੁੰਚਣਾ ਚਾਹੀਦਾ ਸੀ ਪਰ ਉਹ ਪਹੁੰਚਿਆ ਮੇਰੇ ਕੋਲ ਸੱਤ ਦਿਨਾਂ ਦੇ ਵਿੱਚ ਜਿਹਦਾ ਮੈਂ ਉੱਥੇ ਰਿਵਿਊ ਵੀ ਪਾਇਆ ਉਹਨਾਂ ਨੂੰ ਇੱਕ ਨੈਗੇਟਿਵ ਅਤੇ ਉਹ ਪੇਚਕਸ ਦੀ ਕਿੱਟ ਦੇ ਵਿੱਚ ਜਦੋਂ ਮੇਰੇ ਕੋਲ ਪਹੁੰਚੀ ਉਹ ਉਹਨੂੰ ਮੈਂ ਓਪਨ ਕੀਤਾ ਇੱਕ ਤਾਂ ਜਿਹੜੀ ਉਹਦੀ ਗ੍ਰਿਪ ਸੀਗੀ ਉਹ ਉੱਥੇ ਤਾਂ ਅੋਨਲਾਈਨ ਤਾਂ ਰਬੜ ਦੀ ਸ਼ੋਅ ਰਬੜ ਦੀ ਸ਼ੋਅ ਕਰ ਰਹੀ ਸੀ ਪਰ ਜਦੋਂ ਪਹੁੰਚੇ ਉਹ ਪਲਾਸਟਿਕ ਦੀ ਸੀ ਜਿਸ 'ਤੇ ਹੱਥ ਸਲਿਪ ਕਰਦਾ ਗਰਮੀਆਂ ਦੇ ਵਿੱਚ ਅਤੇ ਸੈਕਿੰਡਲੀ ਉਹਦੇ ਨਾਲ ਮੈਨੂੰ ਘੱਟੋ ਘੱਟ ਛੇ ਤੋਂ ਸੱਤ ਬਿਟਸ ਮਿਲਣੀਆਂ ਸੀਗੀਆਂ ਫੋਰ ਹੈਡਿਡ ਵਨ ਹੈਡਿਡ ਅਤੇ ਡਿਫਰੈਂਟ ਸਾਈਜੀਸ ਸਾਈਜੀਸ ਅੱਡ ਅੱਡ ਸੀਗੇ ਉਹ ਵੀ ਮੈਨੂੰ ਪ੍ਰੋਪਰ ਨਹੀਂ ਮਿਲੀਆਂ ਉਹਦੇ ਵਿੱਚੋਂ ਦੋ ਤਿੰਨ ਬਿਟ ਬਿਟਸ ਘੱਟ ਸੀਗੀਆਂ